ਇੱਕ ਲੱਖ ਬਾਰ੍ਹਾਂ ਹਜ਼ਾਰ ਇੱਕ ਸੌ ਬਾਰ੍ਹਾਂ ਚਾਰ ਲੱਖ ਚੌਦ੍ਹਾਂ ਹਜ਼ਾਰ ਚਾਰ ਸੌ ਚੁਤਾਲੀ ਅੱਠ ਲੱਖ ਚੁਤਾਲੀ ਹਜ਼ਾਰ ਛੇ ਸੌ ਛਿਆਹਠ ਨੌ ਲੱਖ ਤੇਈ ਹਜ਼ਾਰ ਦੋ ਸੌ ਇਕਾਹਠ ਸੱਤ ਲੱਖ ਉੱਨੀ ਹਜ਼ਾਰ ਅੱਠ ਸੌ ਵੀਹ